ਅੱਜ ਦੇ ਸਮੇਂ ਵਿੱਚ ਬਿਜਲੀ ਦਾ ਬਹੁਤ ਹੀ ਮਹੱਤਵ ਹੈ ਜਿਵੇਂ ਕਿ ਕਾਰਾਂ ਆਦਿ ਬਿਜਲੀ ਰਾਹੀਂ ਚਾਰਜ ਹੁੰਦੀਆਂ ਹਨ ਇਸ ਲਈ ਇਹ ਬਹੁਤ ਇਨ੍ਹਾਂ ਦੀ ਲੋੜ ਪੈਂਦੀ ਹੈ ਸੋ ਅੱਜ ਦੇ ਸਮੇਂ ਵਿੱਚ ਬਹੁਤ ਲੋਕਾਂ ਕੋਲ ਇਨਵਰਟਰ ਹਨ ਸੋਲਰ ਸਿਸਟਮ ਹਨ ਜੋ ਕਿ ਬਿਜਲੀ ਦੇ ਕੱਟਾਂ ਦੌਰਾਨ ਵਰਤੇ ਜਾਂਦੇ ਹਨ ਅਤੇ ਆਪਣੇ ਹਰ ਰੋਜ਼ ਦੇ ਕੰਮ ਉਹਨਾਂ ਰਾਹੀਂ ਕੀਤੇ ਜਾਂਦੇ ਹਨ